ਮੈਮ ਸਤਿ ਸ਼੍ਰੀ ਕਾਲ ਜੀ ਮੈਮ ਤੁਸੀਂ ਰੋਇਲ ਰੋਪੜ ਤੋਂ ਗੱਲ ਕਰ ਰਹੇ ਹੋਂ ਮੈਮ ਮੈਨੂੰ ਮੇਰੀ ਫਰੈਂਡ ਨੇ ਤੁਹਾਡੇ ਬਾਰੇ ਦੱਸਿਆ ਸੀ ਅਤੇ ਮੈਨੂੰ ਤੁਸੀਂ ਉਹਨਾਂ ਦਾ ਹੇਅਰ ਹੇਅਰ ਟਰੀਟਮੈਂਟ ਕੀਤਾ ਸੀ ਅਤੇ ਸਟਾਈਲ ਵੀ ਕੀਤਾ ਸੀ ਅਤੇ ਮੈਨੂੰ ਉਹਨਾਂ ਦਾ ਟਰੀਟਮੈਂਟ ਬਹੁਤ ਵਧੀਆ ਲੱਗਿਆ ਸੀ ਅਤੇ ਤਾਂ ਕਰਕੇ ਉਹਨਾਂ ਨੇ ਮੈਨੂੰ ਤੁਹਾਡੀ ਰਿਕਮੈਂਡੇਸ਼ਨ ਦਿੱਤੀ ਆ ਮੇਰੇ ਬਰਦਰ ਦੀ ਅਗਲੇ ਮੰਥ ਮੈਰਿਜ ਹੈ ਕੀ ਤੁਸੀਂ ਮੈਨੂੰ ਆਪਣੀ ਹੇਅਰ ਟਰੀਟਮੈਂਟ ਔਰ ਹੇਅਰ ਸਟਾਈਲਸ ਬਾਰੇ ਥੋੜ੍ਹੀ ਇਨਫੋਰਮੇਸ਼ਨ ਦੇ ਸਕਦੇ ਓਂ ਮੈਮ ਮੇਰੇ ਦੀ ਅਗਲੇ ਮੰਥ ਮੈਰਿਜ ਹੈ ਅਤੇ ਮੇਰੇ ਹ ਮੈਂ ਹੇਅਰ ਸਟਾਈਲ ਕਰਵਾਉਣਾ ਚਾਹੁੰਦੀ ਆ ਬਟ ਮੇਰੇ ਵਾਲ ਬਹੁਤ ਹੀ ਡੈਮੇਜ ਹੈ ਇਸ ਕਰਕੇ ਮੈਂ ਪਹਿਲਾਂ ਹੇਅਰ ਟਰੀਟਮੈਂਟ ਕਰਵਾਉਣਾ ਚਾਹੁੰਦੀ ਹੈ ਕਿ ਤੁਸੀਂ ਮੈਨੂੰ ਬਾਰੇ ਦੱਸ ਸਕਦੇ ਹੋ ਮੈਮ ਸ਼ੋਲਡਰ ਤੱਕ ਤਾਂ ਹੋਣਗੇ ਹੀ ਬਾਕੀ ਤੁਸੀਂ ਦੇਖ ਲਿਓ ਓਕੇ ਮੈਮ ਓਕੇ ਮੈਮ ਓਕੇ ਮੈਮ ਕੋਈ ਗੱਲ ਨਹੀਂ ਜੀ ਮੈਂ ਪਰਸੋਂ ਨੂੰ ਤੁਹਾਡੇ ਸਲੂਨ ਵਿੱਚ ਵਿਜਿਟ ਕਰਾਂਗੀ ਅਤੇ ਉੱਤੇ ਤੋਂ ਤੁਸੀਂ ਮੈਨੂੰ ਸਾਰੇ ਆਪਣੇ ਸਟਾਈਲ ਵਗੈਰਾ ਔਰ ਟਰੀਟਮੈਂਟ ਵਗੈਰਾ ਦੱਸ ਦਿਓ ਅਤੇ ਤੁਸੀਂ ਮੈਨੂੰ ਦੱਸ ਦਿਓ ਕਿ ਮੇਰੇ ਫੇਸ ਦੇ ਅਕੋਰਡਿੰਗ ਕਿਹੜਾ ਸਟਾਈਲ ਵਧੀਆ ਲੱਗੂਂਗਾ ਹਾਂਜੀ ਮੈਮ ਮੈਂ ਪਰਸੋਂ ਹੀ ਆਵਾਂਗੀ ਅਤੇ ਟਾਈਮ ਦੱਸ ਦਿਓ ਤੁਸੀਂ ਓਕੇ ਮੈਮ ਇਹ ਕਲੋਜ਼ ਕਦੋਂ ਹੁੰਦਾ ਓਕੇ ਤੁਸੀਂ ਤੁਸੀਂ ਹੋਓਂਗੇ ਜਾਂ ਫਿਰ ਤੁਹਾਡੇ ਅੱਗੇ ਹੋਰ ਜਿਹੜੇ ਲੱਗੇ ਹੁੰਦੇ ਇਮਪਲੋਈ ਤੁਹਾਡੇ ਨਾਲ ਦੇ ਕਲੀਗ ਓਕੇ ਓਕੇ ਚੱਲ ਫੇਰ ਪਰਸੋ ਡਨ ਕਰ ਦਿਓ ਓਕੇ ਥੈਂਕ ਯੂ